ਕੱਪੜੇ ਧੋਣ ਦੀ ਪ੍ਰਕਿਰਿਆ ਕਾਫੀ ਸਧਾਰਨ ਹੈ ਇਸ ਵਿੱਚ ਕੁਝ ਮੁੱਖ ਕਦਮ ਸ਼ਾਮਿਲ ਹੁੰਦੇ ਹਨ ਪਹਿਲਾ ਕੱਪੜਿਆਂ ਨੂੰ ਵੱਖ ਕਰਨਾ ਰੰਗ ਦੇ ਆਧਾਰ 'ਤੇ ਕੱਪੜੇ ਵੱਖ ਕਰੋ ਗੂੜ੍ਹੇ ਰੰਗਾਂ ਨੂੰ ਹਲਕੇ ਰੰਗਾਂ ਤੋਂ ਵੱਖ ਕਰੋ ਦੂਜਾ ਫੈਬਰਿਕ ਦੇ ਅਧਾਰ 'ਤੇ ਵੱਖ ਕਰੋ ਕਪਾਹ ਰੇਸ਼ਮ ਸੂਤੀ ਆਦਿ ਗੰਦੇ ਕੱਪੜਿਆਂ ਨੂੰ ਸਾਫ ਕੱਪੜਿਆਂ ਤੋਂ ਵੱਖ ਕਰੋ ਦੂਸਰਾ ਧੋਣ ਵਾਲੀ ਮਸ਼ੀਨ ਵਿੱਚ ਪਾਉਣਾ ਮਸ਼ੀਨ ਵਿੱਚ ਕੱਪੜੇ ਪਾਉਣ ਤੋਂ ਪਹਿਲਾਂ ਉਨਾਂ ਦੀਆਂ ਜੇਬਾਂ ਖਾਲੀ ਕਰੋ ਜਿੱਦੀ ਦਾਗਾਂ ਵਾਲੇ ਕੱਪੜਿਆਂ ਅਤੇ ਥੱਬਾ ਲਾਉਣ ਵਾਲਾ ਇਜੈਕਟ ਲਗਾਓ ਧੋਣ ਵਾਲੇ ਪਾਊਡਰ ਜਾਂ ਡਰਲ ਇਜੈਕਟਰ ਦੀ ਮਾਤਰਾ ਨੂੰ ਨਿਰਦੇਸ਼ਾਂ ਅਨੁਸਾਰ ਵਰਤੋ ਧੋਣ ਦਾ ਚੱਕਰ ਚੁਣਨਾ ਕੱਪੜੇ ਦਾ ਫੈਬਰਿਕ ਅਤੇ ਗੰਦਗੀ ਦੀ ਮਾਤਰਾ ਦੇ ਆਧਾਰ 'ਤੇ ਧੋਣ ਦਾ ਚੱਕਰ ਚੁਣੋ ਕੱਪੜੇ ਸੁਕਾਉਣਾ ਕੱਪੜੇ ਨੂੰ ਧੁੱਪ ਵਿੱਚ ਸੁਕਾਉਣਾ ਸਭ ਤੋਂ ਵਧੀਆ ਹੈ ਜੇਕਰ ਧੁੱਪ ਨਹੀਂ ਹੈ ਤੁਸੀਂ ਕੱਪੜੇ ਸੁਕਾਉਣ ਵਾਲੀ ਮਸ਼ੀਨ ਜਾਂ ਡਰਾਈ ਕਲੀਨ ਵੀ ਕਰ ਸਕਦੇ ਹੋ ਵੱਖ ਵੱਖ ਫੈਬਰਿਆਂ ਨੂੰ ਧੋਣ ਦੇ ਸੁਝਾਅ ਕਪਾਹ ਗਰਮ ਪਾਣੀ ਵਿੱਚ ਧੋਤਾ ਜਾ ਸਕਦਾ ਹੈ ਰੇਸ਼ਮ ਠੰਢੇ ਪਾਣੀ ਵਿੱਚ ਧੋਤਾ ਜਾ ਸਕਦਾ ਸੂਤੀ ਗਰਮ ਪਾਣੀ ਵਿੱਚ ਧੋਤਾ ਜਾ ਸਕਦਾ ਹੈ ਸਿੰਥੈਟਿਕ ਥੰਡੇ ਪਾਣੀ ਨਾਲ ਧੋਤਾ ਜਾ ਸਕਦਾ ਹੈ